ਇੱਕ ਵਿਦੇਸ਼ੀ ਨੂੰ ਆਪਣੀ ਪਰੰਪਰਾ ਬਾਰੇ ਸੱਭਿਆਚਾਰ ਦਾ ਵਰਨਣ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੋਹਾਲੀ ਭਾਸ਼ਾ ਜ਼ਿਲ੍ਹੇ 'ਚ ਭਾਸ਼ਾ ਭਾਸ਼ਾ ਸਾਡੀ ਪੰਜਾਬੀ ਹੈ ਧਰਮ ਧਰਮ ਅਸੀਂ ਸਾਰੇ ਹੀ ਮੰਨਦੇ ਹਾਂ ਕਿਸੇ ਨੂੰ ਕੋਈ ਕਿਸੇ ਵੀ ਜਾਤ ਪਾਤ ਦਾ ਕੋਈ ਭੇਦ ਭਾਵ ਨਹੀਂ ਹੈਗਾ ਅਤੇ ਰੀਤੀ ਰਿਵਾਜ ਰੀਤੀ ਰਿਵਾਜ ਸਾਡੇ ਇੱਥੇ ਬਹੁਤ ਪੁਰਾਣੇ ਅਤੇ ਬਹੁਤ ਸਾਡੇ ਪਰੰਪਰਾ ਦੇ ਅਨੁਸਾਰ ਚੱਲ ਰਹੇ ਹੈ ਉਹ ਐਵੇ ਵੀ ਜਿਵੇਂ ਸਾਡੇ ਕੋਈ ਪ੍ਰੋਗਰਾਮ ਹੁੰਦਾ ਹੈ ਵਿਆਹ ਸ਼ਾਦੀ ਹੁੰਦੀ ਹੈ ਕੋਈ ਰਿਸ਼ਤੇਦਾਰ ਆਉਂਦਾ ਹੈ ਅਤੇ ਉਹਦੇ ਬਾਅਦ ਵੀ ਆਉਂਦਾ ਅਸੀਂ ਉਹਨੂੰ ਕਦੇ ਵੀ ਖਾਲੀ ਨੀ ਜਾਣ ਦਿੰਦੇ ਸ਼ਗਨ ਅਤੇ ਆਪਣਾ ਵਿਹਾਰ ਕੱਪੜੇ ਦਾ ਜਿਵੇਂ ਕਰਨਾ ਉਵੇਂ ਕਰਦੇ ਹਨ ਅਤੇ ਉਹਨੂੰ ਖੁਸ਼ੀ ਨਾਲ਼ ਹੀ ਮਿਲਦੇ ਹਾਂ ਅਤੇ ਉਹਦੇ ਨਾਲ਼ ਬੈਠਦੇ ਹਾਂ ਆਪਣੇ ਵਿਚਾਰ ਵੀ ਸਾਂਝੇ ਕਰਦੇ ਹਾਂ ਉਹਨਾਂ ਦੀਆਂ ਸੁਣਦੇ ਹਾਂ ਅਤੇ ਆਪਣੀ ਦੱਸਦੇ ਹਾਂ ਕਿ ਕਿਵੇਂ ਸਾਡਾ ਉਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਅੱਗੇ ਹੈ ਜੀ ਧਰਮ ਧਾਰਮਿਕ ਧਰਮ ਇੱਥੇ ਕਿ ਅਸੀਂ ਸਾਰੇ ਹੀ ਧਰਮਾਂ ਨੂੰ ਮੰਨਦੇ ਹਾਂ ਕੋਈ ਐਂਵੇ ਨੀ ਕਹਿੰਦਾ ਵੀ ਮੈਂ ਹਿੰਦੂ ਹਾਂ ਮੁਸਲਿਮ ਹਾਂ ਸਿੱਖ ਹਾਂ ਈਸਾਈ ਕੁਝ ਨਹੀਂ ਹੈ ਸਾਰੇ ਇਕਸਾਰ ਦੇ ਹਨ